ਮੈਂ ਹਰ ਰੋਜ਼ ਸਵੇਰੇ ਭੱਜਣ ਜਾਂਦਾ ਹਾਂ ਅਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਨਾਲ ਫੁੱਟਬੋਲ ਖੇਡਦਾ ਹਾਂ ਰੋਜ਼ ਖੇਲਣ ਨਾਲ ਮੇਰੇ ਬੂਟ ਫਟ ਚੁੱਕੇ ਸੀ ਇਸ ਲਈ ਮੈਂ ਸੋਚਿਆ ਕਿ ਖੇਡਣ ਲਈ ਨਵੇਂ ਬੂਟ ਲੈ ਲਵਾਂ ਪਰ ਮੇਰੇ ਕੋਲ ਨਵੇਂ ਬੂਟ ਲੈਣ ਦਾ ਟਾਈਮ ਨਹੀਂ ਲੱਗ ਰਿਹਾ ਸੀ ਇਸ ਲਈ ਮੈਂ ਇੱਕ ਦਿਨ ਸੋਚਿਆ ਕਿ ਮੈਂ ਆਪਣੇ ਨਵੇਂ ਬੂਟ ਔਨਲਾਈਨ ਹੀ ਮੰਗਵਾ ਲਵਾਂ ਅਤੇ ਜਦੋਂ ਮੈਂ ਔਨਲਾਈਨ ਦੇਖਣ ਲੱਗ ਗਿਆ ਤਾਂ ਮੈਂ ਫਲਿੱਪਕਾਰਡ ਦੀ ਸਾਈਟ 'ਤੇ ਔਨਲਾਈਨ ਬੂਟ ਲੱਭਣ ਲੱਗ ਗਿਆ ਜਿਸ ਵਿੱਚ ਮੈਨੂੰ ਕਾਫੀ ਸਾਰੇ ਬੂਟਾਂ ਬੂਟ ਮਿਲੇ ਅਤੇ ਮੈਨੂੰ ਉਨ੍ਹਾਂ ਵਿੱਚੋਂ ਇੱਕ ਕਾਲੇ ਰੰਗ ਦੇ ਬੂਟ ਕਾਫੀ ਚੰਗੇ ਲੱਗੇ ਜੋ ਕਿ ਦੇਖਣ ਵਿੱਚ ਵੀ ਚੰਗੇ ਸੀ ਅਤੇ ਉਨ੍ਹਾਂ ਦਾ ਸਟੱਫ ਵੀ ਕਾਫੀ ਅੱਛਾ ਦਿਖ ਰਿਹਾ ਸੀ ਇਸ ਇਸ ਲਈ ਮੈਂ ਉਹ ਬੂਟ ਓਡਰ ਦੇ ਦਿੱਤੇ ਉਨ੍ਹਾਂ ਦਾ ਰੇਟ ਵੀ ਕਾਫੀ ਚੰਗਾ ਸੀ ਜਦੋਂ ਉਹ ਓਡਰ ਆਇਆ ਉਸ ਨੂੁੰ ਆਉਣ ਵਿੱਚ ਕਾਫੀ ਟਾਈਮ ਲੱਗ ਗਿਆ ਪਰ ਜਦੋਂ ਮੈਂ ਉਹ ਬੂਟ ਪਾਏ ਤਾਂ ਮੈਨੂੰ ਬਹੁਤ ਚੰਗਾ ਫੀਲ ਹੋਇਆ ਅਤੇ ਹੁਣ ਮੈਂ ਉਹ ਬੂਟ ਰੋਜ਼ ਪਾ ਕੇ ਖੇਡਣ ਜਾਂਦਾ ਹਾਂ ਉਹ ਬੂਟ ਕਾਫੀ ਕਾਫੀ ਚੰਗੇ ਹਨ ਮੈਨੂੰ ਉਹ ਬੂਟ ਬੂਟ ਪਾ ਕੇ ਖੇਡਣ ਵਿੱਚ ਕਾਫੀ ਮਜ਼ਾ ਆਉਂਦਾ ਹੈ ਇਸ ਲਈ ਉਹ ਬੂਟ ਕਾਫੀ ਮੈਨੂੰ ਚੰਗੇ ਲੱਗੇ